ਮੈਂ ਬਾਹਰੀ ਗਤੀਵਿਧੀਆਂ ਜਾਂ ਆਊਟਡੋਰ ਸਪੋਰਟਸ ਵਿੱਚ ਦੌੜਨ ਨੂੰ ਤਰਜੀਹ ਦਿੰਦਾ ਹਾਂ ਕਿਉਂਕਿ ਇਸ ਦੇ ਵਿੱਚ ਤੁਸੀਂ ਬਿਨਾ ਕੋਈ ਵਾਧੂ ਖਰਚਾ ਕੀਤੇ ਆਪਣੀ ਸਿਹਤ ਨੂੰ ਮੇਨਟੇਨ ਕਰ ਸਕਦੇ ਹੋ ਤੁਸੀਂ ਸਲੋਅ ਦੌੜਨਾ ਜਾਂ ਤੇਜ਼ ਦੌੜਨਾ ਇਹ ਡਿਪੈਂਡ ਕਰਦਾ ਜੀ ਕਿ ਤੁਸੀਂ ਕਿਸ ਮੂਡ ਦੇ ਵਿੱਚ ਹੋ ਤੁਸੀਂ ਸੈਰ ਵੀ ਕਰ ਸਕਦੇ ਹੋ ਤੁਸੀਂ ਸਲੋਅ ਪੇਸ ਦੇ ਉੱਤੇ ਦੌੜ ਸਕਦੇ ਹੋ ਇਹ ਹਰ ਇੱਕ ਦੌੜ ਦਾ ਅਲੱਗ ਅਲੱਗ ਫਾਇਦਾ ਹੁੰਦਾ ਹੈ ਜਦੋਂ ਤੁਸੀਂ ਕੋਈ ਫਾਸਟ ਟਰੇਨਿੰਗ ਕਰਨੀ ਹੋਵੇ ਤਾਂ ਛੋਟੇ ਛੋਟੇ ਫਾਸਲੇ 'ਤੇ ਤੇਜ਼ ਦੌੜ ਕੇ ਫਿਰ ਸਲੋਅ ਰਨਿੰਗ ਫਿਰ ਤੇਜ਼ ਦੌੜ ਕੇ ਫਿਰ ਸਲੋਅ ਰਨਿੰਗ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ